ਹਾਂਜੀ ਮੈਂ ਸਿਲਾਈ ਕਢਾਈ ਦੋਨੇ ਹੀ ਕਰ ਲੈਂਦੀ ਹਾਂ ਕਿਉਂਕਿ ਮੇਰਾ ਕੰਮ ਇਹੀ ਚਲਦਾ ਹੈ ਅਤੇ ਮੈਂ ਕੋਟੀਆਂ ਸਵੈਟਰਾਂ ਦਸਤਾਨੇ ਵਗੈਰਾ ਸਾਰਾ ਕੁਛ ਕਰ ਪਹਿਲਾਂ ਤਾਂ ਮੈਂ ਡਿਜਾਇਨ ਉਂ ਉਂਝ ਸਵੈਟਰਾਂ ਕੋਟੀਆਂ ਤੋਂ ਲਾ ਲਾਉਂਦੀ ਸੀ ਹੁਣ ਮੈਂ ਦੂਜਿਆਂ ਦੀ ਯੂਟੀਊਬ ਤੋਂ ਵੇਖ ਕੇ ਡਿਜ਼ਾਇਨ ਲਾ ਲੈਨੀ ਹਾਂ ਬੱਚੇ ਗੁੱਡੀਆਂ ਮੇਰੀਆਂ ਕਹਿੰਦੀਆਂ ਹੈ ਕਿ ਮੰਮੀ ਸਾਨੂੰ ਇਹ ਡਿਜ਼ਾਇਨ ਲਾ ਕੇ ਦੇ ਮੈਂ ਉਹਨਾਂ ਦੇ ਸਵੈਟਰਾਂ ਜੈਕਟਾਂ ਵਗੈਰਾ ਸਾਰਾ ਕੁਛ ਮੈਂ ਉਹਨਾਂ ਨੂੰ ਯੂਟੀਊਬ ਤੋਂ ਲਾ ਕੇ ਬਣਾ ਦੇਣੀ ਹਾਂ ਕਈ ਗਾਹਕ ਮੇਰੇ ਕੋਲ ਕਸਟਮਰ ਬਹੁਤ ਆ ਜਾਂਦੇ ਹਨ ਉਹਨਾਂ ਕਰਕੇ ਮੇਰੀ ਬਹੁਤ ਮਸ਼ਹੂਰੀ ਸਵੈਟਰਾਂ ਕੋਟੀਆਂ ਦੀ ਹੋ ਜਾਂਦੀ ਹੈ ਜਿਸ ਕਰਕੇ ਗਾਹਕ ਮੇਰੇ ਕੋਲ ਬਹੁਤ ਜ਼ਿਆਦਾ ਆ ਜਾਂਦੇ ਹਨ ਕਿਉਂਕਿ ਮੈਂ ਉਹਨਾਂ ਅਤੇ ਰੇਟ ਸਹੀ ਸਹੀ ਲਾ ਕੇ ਰੱਖਦੀ ਹਾਂ ਕਿਉਂਕਿ ਗਾਹਕ ਮੇਰੇ ਕੋਲ ਜ਼ਿਆਦਾ ਤੋਂ ਜ਼ਿਆਦਾ ਆਉਣ ਅਤੇ ਮੇਰਾ ਕੰਮ ਬਹੁਤ ਸਰਕਲ ਵਧੀਆ ਚੱਲੀ ਜਾਵੇ ਇਸ ਕਰਕੇ ਮੈਂ ਯਾਨੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦੀ ਰਹਿੰਦੀ ਹਾਂ ਕਿ ਮੇਰਾ ਕੰਮ ਬਹੁਤ ਚੰਗਾ ਚੱਲੀ ਜਾਵੇ ਕਿਉਂ ਦਸਤਾਨੇ ਵਗੈਰਾ ਸਵੈਟਰ ਕੋਟੀਆਂ ਬੱਚਿਆਂ ਦੇ ਵੀ ਮੈਂ ਸਾਰੇ ਬਣਾ ਲੈਂਦੀ ਹਾਂ ਬੱਚਿਆਂ ਨੂੰ ਦਾ ਬਣਾਉਣ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਕ ਹੈ ਇਸ ਕਰਕੇ ਮੈਂ ਆਪਣੇ ਬੱਚਿਆਂ ਦੇ ਹੋਰ ਬੱਚੇ ਬੱਚਿਆਂ ਨੇ ਵੀ ਬਣਾ ਦੇਣੀ ਹੈ ਕਿਉਂਕਿ ਇਹ ਮੇਰੀ ਮਿਹਨਤ ਦਾ ਫਲ ਹੈ ਇਸ ਕਰਕੇ ਮੈਂ ਜ਼ਿਆਦਾ ਕੁਛ ਨਹੀ ਕਹਿ ਸ